ਹਾਲਾਂਕਿ ਮੈਂ ਮਸ਼ਹੂਰ ਲੇਖਕਾਂ ਵਾਂਗ ਤਾਂ ਨਹੀਂ ਹਾਂ ਪਰ ਮੇਰਾ ਆਪਣੇ ਕੰਮ ਦੇ ਨਾਲ ਨਾਲ ਇੱਕ ਛੋਟਾ ਜਿਹਾ ਸ਼ੌਂਕ ਹੈ ਜੋ ਲਿਖਣਾ ਹੈ ਅਤੇ ਮੈਂ ਅ ਜਦ ਵੀ ਅ ਖਾਲੀ ਸਮਾਂ ਮੈਨੂੰ ਮਿਲਦਾ ਹੈ ਮੈਂ ਆਪਣੀ ਜ਼ਿੰਦਗੀ ਬਾਰੇ ਜੋ ਹੋਇਆ ਹੈ ਜਾਂ ਕੁਛ ਔਰ ਮੁੱਦ ਮੁੱਦਿਆ ਬਾਰੇ ਮੈਂ ਲਿਖਣਾ ਜ਼ਰੂਰ ਪਸੰਦ ਕਰਦੀ ਹਾਂ ਔਰ ਜੇਕਰ ਮੈਂ ਗੱਲ ਕਰਾਂ ਤਾਂ ਮੈਨੂੰ ਸਿਹਤ ਅਤੇ ਸੰਭਾਲ ਬਾਰੇ ਲਿਖਣਾ ਵੀ ਬਹੁਤ ਅੱਛਾ ਲੱਗਦਾ ਹੈ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਲੋਕ ਆਪਣੀ ਸਿਹਤ ਆਪਣੇ ਖਾਣ ਪੀਣ ਬਾਰੇ ਨਹੀਂ ਧਿਆਨ ਦਿੰਦੇ ਹਨ ਬੱਸ ਆਪਣੀ ਰੋਜ਼ ਮਟਾਜ਼ੀ ਦੀ ਜ਼ਿੰਦਗੀ ਵਿੱਚ ਲੱਗੇ ਰਹਿੰਦੇ ਹਨ ਅਤੇ ਆਪਣੇ ਆਪ ਨੂੰ ਬਿਲਕੁਲ ਸਮਾਂ ਨਹੀਂ ਦਿੰਦੇ ਹਨ ਉਹਨਾਂ ਨੂੰ ਇੱਕ ਤਾਂ ਆਪਣੀ ਰੋਜ਼ਾਨਾ ਦੀ ਰੁਟੀਨ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਸਿਹਤ ਨੂੰ ਸਹੀ ਬਣਾਏ ਰੱਖਣ ਲਈ ਸਭ ਤੋਂ ਪਹਿਲੇ ਤਾਂ ਵੇਰਵਾ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਦਿਨ ਵਿੱਚ ਕਿਆ ਖਾਣਾ ਚਾਹੀਦਾ ਹੈ ਕਿਆ ਨਹੀਂ ਖਾਣਾ ਚਾਹੀਦਾ ਹੈ ਕਿਹੜੀ ਚੀਜ਼ਾਂ ਉਹਨਾਂ ਨਾਲ ਉਹਨਾਂ ਲਈ ਅੱਛੀਆਂ ਹੁੰਦੀਆਂ ਹਨ ਕਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਉਸ ਤੋਂ ਇਲਾਵਾ ਜੇ ਮੈਂ ਉਹਨਾਂ ਦੇ ਰਹਿਣ ਸਹਿਣ ਬਾਰੇ ਗੱਲ ਕਰਾਂ ਤਾਂ ਉਹਨਾਂ ਨੂੰ ਆਪਣੇ ਰਹਿਣ ਸਹਿਣ ਵਿੱਚ ਵੀ ਬਦਲਾਵ ਲੈ ਕੇ ਆਉਣਾ ਚਾਹੀਦਾ ਹੈ ਉਨ੍ਹਾਂ ਨੂੰ ਅਗਰ ਪਹਿਰਾਵੇ ਦੀ ਗੱਲ ਕਰੀਏ ਸਮੇਂ ਦੇ ਹਿਸਾਬ ਨਾਲ ਪਹਿਰਾਵਾ ਕੋਈ ਜਗ੍ਹਾ 'ਤੇ ਜਾਣਾ ਹੈ ਉਹਨਾਂ ਨੇ ਆਪਣੀ ਜੋਬ 'ਤੇ ਜਾਣਾ ਹੈ ਤਾਂ ਕਿਸ ਤਰੀਕੇ ਦਾ ਪਹਿਰਾਵਾ ਪਹਿਨਣਾ ਚਾਹੀਦਾ ਹੈ ਮੈਨੂੰ ਲਾਈਫ ਸਟਾਈਲ 'ਤੇ ਉਹਨਾਂ ਦੀ ਸਿਹਤ ਸਾਂਭ ਸੰਭਾਲ ਬਾਰੇ ਲਿਖਣਾ ਬਹੁਤ ਚੰਗਾ ਲੱਗਦਾ ਹੈ